ਨਮਸਕਾਰ ਜੀ ਅਮਨ ਟਰੈਵਲਸ ਤੋਂ ਗੱਲ ਕਰ ਰਹੇ ਹੋ ਸਰ ਮੈਂ ਡੋਕਟਰ ਰੀਚਾ ਗੱਲ ਕਰ ਰਹੀ ਹਾਂ ਪੰਜਾਬੀ ਯੂਨੀਵਰਸਿਟੀ ਤੋਂ ਮੈਂ ਕੈਬ ਬੁੱਕ ਕਰਵਾਈ ਸੀ ਮੈਂ ਪਟਿਆਲਾ ਤੋਂ ਚੰਡੀਗੜ੍ਹ ਜਾਣਾ ਸੀ ਅਤੇ ਡਰਾਈਵਰ ਦਾ ਨਾਮ ਸੁਖਵਿੰਦਰ ਸਿੰਘ ਸੀ ਮੈਂ ਪਿਛਲੇ ਅੱਧੇ ਘੰਟੇ ਤੋਂ ਡਰਾਈਵਰ ਦੀ ਵੇਟ ਕਰ ਰਹੀ ਹਾਂ ਅਤੇ ਉਹ ਹਜੇ ਤੱਕ ਪਹੁੰਚਿਆ ਨਹੀਂ ਮੇਰੀ ਮੀਟਿੰਗ ਬਹੁਤ ਜ਼ਰੂਰੀ ਹੈ ਅਤੇ ਜਿਸ ਕਰਕੇ ਮੈਂ ਉਸਦੀ ਹੋਰ ਜ਼ਿਆਦਾ ਵੇਟ ਨਹੀਂ ਕਰ ਸਕਦੀ ਮੈਂ ਪਿਛਲੇ ਪੰਦਰਾਂ ਵੀਹ ਮਿੰਟਾਂ ਤੋਂ ਉਸਨੂੰ ਲਗਾਤਾਰ ਕਾਲ ਕਰ ਰਹੀ ਹਾਂ ਪਰ ਮੇਰਾ ਫੋਨ ਨਹੀਂ ਚੁੱਕ ਰਿਹਾ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਤੁਹਾਡੇ ਏਜੰਸੀ ਦੇ ਨਾਲ ਬਹੁਤ ਹੀ ਘਟੀਆ ਐਕਸਪੀਰੀਅੰਸ ਰਿਹਾ ਹੈ ਅਤੇ ਮੈਂ ਆਪਣੀ ਕੈਬ ਨੂੰ ਰੱਦ ਕਰਦੀ ਹਾਂ ਧੰਨਵਾਦ